ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਤੁਸੀਂ ਦੱਸੋ ਜੀ ਕਿਵੇਂ ਹੋ ਹਾਂਜੀ

ਓਕੇ ਜੀ ਹਾਂਜੀ ਤੁਹਾਡੇ ਜਦੋਂ ਤੁਸੀਂ ਹੈ ਨਾ ਅਪੋਆਇੰਟਮੈਂਟ ਲਈ ਤੁਸੀਂ ਆਉਂਗੇ ਇੱਥੇ ਸਾਡੇ ਕੋਲ ਮੇਕਅਪ ਆਰਟ 'ਚ ਉਦੋਂ ਮੈਂ ਤੁਹਾਨੂੰ ਦੱਸ ਦੂੰਗੀ ਵੀ ਤੁਹਾਡੇ 'ਤੇ ਕਿੱਦਾਂ ਦੀ ਲੁੱਕ ਅਤੇ ਮਤਲਬ ਕਿੱਦਾਂ ਦੀ ਡਰੈਸ ਵਧੀਆ ਲੱਗੇਗੀ ਅਤੇ ਕਿੱਦਾਂ ਦਾ ਹੀ ਮੇਕਅਪ ਹੇਅਰ ਸਟਾਈਲ ਵਗੈਰਾ ਉੱਦਾਂ ਹੀ ਦੱਸ ਦਵਾਂਗੇ ਅਸੀਂ ਹਾਂਜੀ ਹੋਰ ਕੁਝ ਪੁੱਛਣਾ ਜੀ ਅੱਛਾ ਜੀ ਕਿੱਦਾਂ ਦਾ ਕਰਵਾਉਣਾ ਹੇਅਰ ਸਟਾਈਲ ਤੁਸੀਂ ਹਾਂਜੀ ਉੱਦਾਂ ਦੀ ਸਟਾ ਕਰਾਂਗੇ ਜਿੱਦਾਂ ਦੀ ਤੁਸੀਂ ਪਾਰਟੀ ਜਾਂ ਫੰਕਸ਼ਨ ਵਗੈਰਾ 'ਤੇ ਕਿਤੇ ਵੀ ਜਾਣਾ ਹੋਵੇ ਅਸੀਂ ਉੱਦਾਂ ਦੀ ਕਰਾਂਗੇ ਤੁਸੀਂ ਦੱਸੋਗੇ ਅਤੇ ਤੁਹਾਨੂੰ ਕਿੱਦਾਂ ਦਾ ਚਾਹੀਦਾ ਜੀ

ਕੋਈ ਨਾ ਜੀ ਹੈਗਾ ਜੀ ਪ੍ਰਾਈਸ ਤਾਂ ਪੱਚੀ ਸੌ ਤੱਕ ਦੋ ਹਜ਼ਾਰ ਤਿੰਨ ਹਜ਼ਾਰ ਤੱਕ ਹੈਗਾ ਜੀ ਉੱਦਾਂ ਦੀ ਹੋਊਗਾ ਜਿੱਦਾਂ ਤੁਸੀਂ ਮੇਕਅਪ ਚਾਹੀਦਾ ਤੁਹਾਨੂੰ ਜੀ ਮਤਲਬ ਵਧੀਆ ਚਾਹੀਦਾ ਜਾਂ ਕਿੱਦਾਂ ਘਟੀਆ ਚਾਹੀਦਾ ਕਿਵੇਂ ਦਾ ਤੁਹਾਨੂੰ ਅੱਛਾ ਕੋਈ ਨਾ ਜੀ ਕਰ ਦਵਾਂਗੇ ਜੀ ਕੋਈ ਨਾ ਕੋਈ ਨਾ ਜੀ ਕਰ ਦਵਾਂਗੇ ਜੀ ਤੁਸੀਂ ਇੱਕ ਵਾਰ ਆ ਜਿਓ ਮੈਂ ਤੁਹਾਨੂੰ ਦੱਸ ਦੂੰਗੀ ਡੇਟ ਵਗੈਰਾ ਟਾਈਮ ਵੀ ਕਦੋਂ ਆਉਣਾ ਹਾਂਜੀ ਨਹੀਂ ਕੋਈ ਨਾ ਜੀ ਕੋਈ ਨਾ ਜੀ ਤੇ ਤੁਹਾਡਾ ਖਾਣਾ ਪੀਣਾ ਇੱਥੇ ਹੋਊਗਾ ਜੀ ਤੁਸੀਂ ਫਿਕਰ ਨਾ ਕਰੋ ਇ ਇਸ ਗੱਲ ਦਾ ਟਾਈਮ ਵੀ ਬਹੁਤ ਲੱਗੇਗਾ ਜੀ ਉਸ ਲਈ ਤੁਹਾਨੂੰ ਸਪੈਸ਼ਲ ਮਤਲਬ ਟਾਈਮ ਕੱਢ ਕੇ ਆਉਣਾ ਪਊਗਾ ਜੀ ਹਾਂਜੀ ਚਲੋ ਮਤਲਬ ਤੁਹਾਨੂੰ ਹੋਰ ਕੋਈ ਮਤਲਬ ਕਿਸੇ ਹੋਰ ਨੇ ਰ ਰੈਡੀ ਹੋਣਾ ਹੋਵੇ ਤਾਂ ਦੱਸ ਸਕਦੇ ਹੋ ਮਤਲਬ ਵਧੀਆ ਇੱਥੇ ਮੇਕਅਪ ਵਧੀਆ ਕਰਵਾਉਂਦੇ ਆ ਹੇਅਰ ਸਟਾਇਲ ਵਗੈਰਾ ਮਤਲਬ ਮੇਕਅਪ ਆਰਟ 'ਚ ਮਤਲਬ ਬਹੁਤ ਵਧੀਆ ਉਹ ਹੁੰਦੇ ਹੈਗੇ ਮਤਲਬ ਬਲੀਚ ਵਗੈਰਾ ਵਧੀਆ ਕਰਦੇ ਆ ਸਾਡੇ ਕਸਟਮਰ ਜੀ ਉਹਨਾਂ ਲਈ ਉਹਨਾਂ ਲਈ ਵਧੀਆ ਆਉਂਦੇ ਆ ਜੀ ਇੱਥੇ ਕਸਟਮਰ ਮਤਲਬ ਸਾਡਾ ਮਸ਼ਹੂਰ ਸਲੂਨ ਆ ਜੀ ਇੱਥੇ

ਹਾਂਜੀ ਸਾਰਾ ਕੁਝ ਸਾਰੇ ਕਾਸੇ ਦਾ ਅਰੇਂਜਮੈਂਟ ਹੈਗਾ ਜੀ ਹਾਂਜੀ ਓਕੇ ਜੀ